ਸਾਡਾ ਪਿੰਡ ਪ੍ਰੇਮਨਗਰ ਹੈ ਸਾਡਾ ਪਿੰਡ ਵਿੱਚ ਇੱਕ ਬਹੁਤ ਬੜਾ ਮੰਦਰ ਹੈ ਜਿਸਨੂੰ ਸ਼ਿਵ ਮੰਦਿਰ ਕਹਿੰਦੇ ਹਨ ਇਸ ਸ਼ਿਵ ਮੰਦਿਰ ਵਿੱਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਨਿਊ ਯੀਅਰ ਸਾਰਾ ਕੁਛ ਮਨਾਇਆ ਜਾਂਦਾ ਹੈ ਦੁਰਗਾ ਪੂਜਾ ਦੁਰਗਾ ਪੂਜਾ ਬਹੁਤ ਬੜਾ ਬਹੁਤ ਵਿਸ਼ਾਲ ਮਨਾਇਆ ਜਾਂਦਾ ਹੈ ਹੈ ਨਾ ਦਸ ਦਿਨ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ ਇਹ ਇਹਦੇ ਵਿੱਚ ਰੋਜ਼ ਕੀਰਤਨ ਹੁੰਦੇ ਹਨ ਅਤੇ ਹਰ ਮਹੀਨੇ ਵਿੱਚ ਇੱਕ ਮੰਗਲਵਾਰ ਆਉਂਦਾ ਹੈ ਉਸ ਮੰਗਲਵਾਰ ਨੂੰ ਵੀ ਕੀਰਤਨ ਕਰਦੇ ਹਨ ਅਤੇ ਭੰਡਾਰਾ ਲਾਉਂਦੇ ਹਨ ਇੱਥੇ ਕੜ੍ਹੀ ਚਾਵਲ ਦਾ ਹੈ ਨਾ ਇੱਥੇ ਗੁਰਪੁਰਬ ਦਸੰਬਰ ਵਿੱਚ ਆਉਂਦਾ ਹੈ ਵੋ ਵੀ ਅਸੀਂ ਮਨਾਉਂਦੇ ਹਾਂ ਅਤੇ ਲੰ ਸਾਰੇ ਮਿਲ ਕੇ ਲੰਗਰ ਵੀ ਲਾਉਂਦੇ ਹਾਂ ਇੱਥੇ ਅਤੇ ਸ਼ਿਵਰਾਤਰੀ ਵੀ ਨਿਊ ਯੀਅਰ ਬੱਚਿਆਂ ਦੇ ਸਾਰੇ ਪ੍ਰੋਗਰਾਮ ਬੱਚੇ ਕਰਦੇ ਹਾਂ ਆਪਣਾ ਡਾਂਸ ਹੋ ਗਿਆ ਸਾਰਾ ਕੁਛ ਕਰਦੇ ਹਾਂ ਅਤੇ ਇੱਥੇ ਜਾਗਰਨ ਵੀ ਕ ਕੀਤੇ ਜਾਂਦੇ ਹਨ ਦੋ ਦੋ ਤਿੰਨ ਤਿੰਨ ਦਿਨ ਤੱਕ ਸਾਡਾ ਇੱਥੇ ਜਾਗਰਨ ਹੁੰਦਾ ਆ